ਹਾਂਜੀ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਜਿਹੜੀ ਯੋਗ ਕਲਾਸ ਹੈ ਉਹ ਸਾਰੇ ਹੀ ਵਿਅਕਤੀਆਂ ਲਈ ਬਹੁਤ ਹੀ ਮਹੱਤਵਪੂਰਨ ਰੱਖਦੀ ਹੈ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਸੁੰਦਰ ਅਤੇ ਖੁਸ਼ਹਾਲ ਰੱਖਦੀ ਹੈ ਯੋਗ ਕਰਦਾ ਹੈ ਵਿਅਕਤੀ ਤਾਂ ਉਹ ਤੰਦਰੁਸਤ ਰਹਿੰਦਾ ਹੈ ਸਿਹਤਮੰਦ ਰਹਿੰਦਾ ਹੈ ਐਦਾਂ ਹੀ ਆਪਾਂ ਹਰ ਕੋਈ ਤਾਂ ਨਹੀਂ ਹਰ ਇੱਕ ਪਰਸਨਲ ਪਰਸਨ ਘਰ ਵੀ ਯੋਗ ਕਰਦਾ ਹੈ ਪਰ ਤੁਹਾਨੂੰ ਵੀ ਪਤਾ ਹੈ ਕਿ ਜਿਹੜੀ ਯੋਗ ਕਲਾਸ ਆਪਾਂ ਘਰ ਕਰਦੇ ਹਾਂ ਅਤੇ ਇੱਕ ਕਿਸੇ ਤੋਂ ਜਾ ਕੇ ਲੈਣੀ ਯੋਗ ਕਰਨਾ ਕਿਸੇ ਆਸ਼ਰਮ ਦੇ ਵਿੱਚ ਜਾਂ ਕਿਸੇ ਪਾਰਕ ਦੇ ਵਿੱਚ ਕਿਸੇ ਗੁਰੂ ਦੇ ਦੁਆਰਾ ਤਾਂ ਉਹ ਜਿਹੜਾ ਯੋਗ ਕਲਾਸ ਹੈ ਆਪਾਂ ਲੈਂਦੇ ਹਾਂ ਤਾਂ ਉਹਦੇ ਵਿੱਚ ਬਹੁਤ ਹੀ ਫਰਕ ਹੁੰਦਾ ਆਪਾਂ ਖੁਦ ਕਈ ਵਾਰ ਐਦਾਂ ਦੇ ਤਾੜ ਆਸਣ ਲਾ ਲਉ ਜਾਂ ਐਦਾਂ ਦੇ ਆਸਣ ਖੁਦ ਕਰਨਾ ਸਟਾਟ ਕਰਦੇ ਹਾਂ ਜਿਹਦੇ ਨਾਲ ਆਪਾਂ ਨੂੰ ਬਹੁਤ ਹੀ ਕਈ ਵਾਰ ਹਾਨੀਕਾਰਕ ਹੋ ਜਾਂਦਾ ਤੁਹਾਨੂੰ ਵੀ ਪਤਾ ਹੈ ਕਈ ਵਾਰ ਆਪਾਂ ਇਹੋ ਜਿਹਾ ਕੋਈ ਨਾੜ ਵਿੰਗੀ ਹੋ ਜਾਂਦੀ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਕੋਈ ਫੈਕਚਰ ਵਗੈਰਾ ਹੋ ਜਾਂਦਾ ਹੈ ਆਪਾਂ ਇੱਕੋਂ ਦਮ ਕੋਈ ਮੂਵ ਕਰ ਲੈਂਦਾ ਆਪਣੀ ਨੈੱਕ ਕ ਹੈ ਨਾ ਆਰਮ ਵਗੈਰਾ ਤਾਂ ਇਸ ਲਈ ਸਾਨੂੰ ਕਲਾਸ ਦੇ ਵਿੱਚ ਜਾ ਕੇ ਇੱਕ ਵਾਰ ਤਜ਼ਰਬਾ ਜ਼ਰੂਰ ਲੈਣਾ ਇਸ ਤਰ੍ਹਾਂ ਮੈਂ ਵੀ ਇੱਕ ਕਲਾਸ ਦੇ ਵਿੱਚ ਜਾ ਕੇ ਤਜ਼ਰਬਾ ਲਿਆ ਸੀ ਤਾਂ ਉਹ ਮੇਰਾ ਬਹੁਤ ਹੀ ਵਧੀਆ ਤਜ਼ਰਬਾ ਰਿਹਾ ਹੈ ਮੈਂ ਬਹੁਤ ਅਭਿਆਨ ਕੀਤਾ ਬਹੁਤ ਹੀ ਵਧੀਆ ਮੇਰੇ ਗੁਰੂ ਨੇ ਮੈਨੂੰ ਸਿਖਾਇਆ ਮੈਂ ਹਰ ਰੋਜ਼ ਹੀ ਜਾਂਦੀ ਸੀ ਔਰ ਵਧੀਆ ਹੀ ਕਲਾਸ ਰਿ ਰੱਖ ਕੇ ਆਉਂਦੀ ਸੀ